ਖੇਡਾਂ ਲੋਕਾਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤ ਵਿੱਚ ਬਹੁਤ ਯੋਗਦਾਨ ਪਾਉਂਦੀ ਹੈ ਬਹੁਤ ਤਰ੍ਹਾਂ ਦੇ ਖੇਡ ਹੁੰਦੇ ਨੇ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ ਜਿਵੇਂ ਕਿ ਹੋਕੀ ਬੈਡਮਿੰਟਨ ਕਬੱਡੀ ਆਦਿ ਗੇਮਾਂ ਨੇ ਜੋ ਕਿ ਸਾਨੂੰ ਖੇਲ ਕੇ ਸੰਤੁਸ਼ਟੀ ਮਿਲਦੀ ਹੈ ਅਸੀਂ ਘਰ ਵਿੱਚ ਰਹਿ ਕੇ ਵੀ ਆਰਾਮ ਨਾਲ ਖੇਲ ਖੇਡ ਸਕਦੇ ਹਨ ਆਪਣੇ ਅਂਗ ਆਂਗਣ ਵਿੱਚ ਖੇਲ ਸਕਦੇ ਹਨ ਆਪਣੇ ਭਾਈ ਭੈਣ ਦੇ ਨਾਲ਼ ਖੇਲ ਸਕਦੇ ਹਨ ਜੋ ਗੇਮਾਂ ਅਸੀਂ ਗੇਮਾਂ ਸਾਡੇ ਮਾਈਂਡ ਨੂੰ ਫਰੈਸ਼ ਕਰਦਾ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਤੰਦਰੁਸਤ ਕਰਦਾ ਹੈ ਖੇਡਾਂ ਨਾਲ਼ ਅਸੀਂ ਹਰ ਉਸ ਕੰਮ ਨੂੰ ਕਰਨ ਵਿੱਚ ਕੋਈ ਵੀ ਕੰਮ ਕਰਨ ਲਈ ਫਰੈਸ਼ ਫੀਲ ਖੇਡਾਂ ਖੇਡਾਂ ਤੋਂ ਅਸੀਂ ਕੋਈ ਵੀ ਕੰਮ ਕਰਨ ਵਿੱਚ ਫਰੈਸ਼ ਫੀਲ ਕਰਦੇ ਨੇ ਖੇਡਾਂ ਸਾਨੂੰ ਹਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਸਾਨੂੰ ਤੰਦਰੁਸਤ ਰੱਖਦਾ ਹੈ ਖੇਡਾਂ ਹੀ ਸਾਨੂੰ ਸਾਡੇ ਸਰੀਰ ਨੂੰ ਤਨਾਓ ਦਿੰਦਾ ਹੈ ਅਤੇ ਅਸੀਂ ਸਾਡੇ ਸਰੀਰ ਵਿੱਚ ਲਚਕੀਲਾਓ ਲਚਕੀਲਾਪਣ ਲਾਉਂਦਾ ਹੈ ਖੇਲ ਨਾਲ਼ ਅਸੀਂ ਹਰ ਕੰਮ ਕਰਨ ਵਿੱਚ ਸਫ਼ਲ ਹੁੰਦੇ ਨੇ